ਹੈਲੋ ਫਲਿਪਕਾਰਟ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਤੁਹਾਡਾ ਥੈਂਕ ਯੂ ਬਹੁਤ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਜਿਹੜੀ ਹੈਗੀ ਆ ਸਮਾਰਟਵੋਚ ਜਿਹੜੀ ਹੈਗੀ ਆ ਔਨਲਾਈਨ ਔਡਰ ਕਰਕੇ ਮੰਗਵਾਈ ਸੀ ਅਤੇ ਮੈਂ ਉਹ ਦੇਖ ਕੇ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਸ ਤਰ੍ਹਾਂ ਦੀਆਂ ਮੇਰੀ ਜਿਸ ਤਰ੍ਹਾਂ ਦੀ ਮੇਰੀ ਉਮੀਦ ਸੀਗੀ ਵੀ ਮੈਨੂੰ ਜਿਸ ਤਰ੍ਹਾਂ ਦੀ ਵੋਚ ਚਾਹੀਦੀ ਆ ਉਹ ਜਮ੍ਹਾਂ ਉਸ ਤਰ੍ਹਾਂ ਦੀ ਸੀਗੀ ਮੈਨੂੰ ਪਹਿਲਾਂ ਬਹੁਤ ਡਰ ਲੱਗ ਰਿਹਾ ਸੀ ਵੋਚ ਆਉਣ ਤੋਂ ਪਹਿਲਾਂ ਮੈਨੂੰ ਇਸ ਤਰ੍ਹਾਂ ਸੀਗਾ ਵੀ ਵੋਚ ਕਿਸ ਤਰ੍ਹਾਂ ਦੀ ਹੋਊਗੀ ਕੋਈ ਉਸ ਵਿੱਚ ਫੋਲਟ ਨਾ ਹੋਵੇ ਸੋ ਮੈਂ ਵੋਚ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਵੋਚ ਦੇ ਲੈਣ ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਸਾਈਟਸ 'ਤੇ ਵਿਜ਼ਿਟ ਕੀਤਾ ਬਟ ਉੱਥੇ ਪ੍ਰਾਈਜ਼ ਵੀ ਬਹੁਤ ਜ਼ਿਆਦਾ ਸੀਗੇ ਅਤੇ ਬਟ ਐਂਡ ਵੋਚ ਦੇ ਉੱਪਰ ਕੁਛ ਭਰੋਸੇਯੋਗ ਵੀ ਨਹੀਂ ਸੀਗਾ ਸੋ ਮੈਂ ਫਲਿਪਕਾਰਟ ਚੂਜ਼ ਕੀਤਾ ਮੈਂ ਇਹ ਪਹਿਲੀ ਡਿਲੀਵਰੀ ਫਲਿਪਕਾਰਟ ਤੋਂ ਕੀਤੀ ਸੀਗੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਤੋਂ ਮੰਗਵਾਇਆ ਉਹਦੇ ਵਿੱਚ ਸਾਰੇ ਫੀਚਰਸ ਹੈਗੇ ਆ ਜੋ ਕਿ ਵੋਚ ਦੇ ਵਿੱਚ ਦਿਖਾਏ ਗਏ ਸੀਗੇ ਐਪ ਦੇ ਵਿੱਚ ਦਿਖਾਏ ਗਏ ਸੀ ਬੀ ਪੀ ਚੈਕ ਨੋਰਮਲ ਸਾਰਾ ਸਭ ਕੁਛ ਬਹੁਤ ਵਧੀਆ ਹੈਗਾ ਅਤੇ ਮੈਂ ਇਹ ਵੋਚ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਅਤੇ ਮੇਰੇ ਫਰੈਂਡਸ ਨੇ ਵੀ ਮੈਨੂੰ ਇਸ ਬਾਰੇ ਪੁੱਛਿਆ ਵੀ ਤੁਸੀਂ ਇਹ ਵੋਚ ਕਿੱਥੋਂ ਲੈਤੀ ਆ ਅਤੇ ਮੈਂ ਉਹਨਾਂ ਨੂੰ ਰੈਕਮੈਂਡ ਕੀਤਾ ਵੀ ਤੁਸੀਂ ਫਲਿਪਕਾਰਟ ਤੋਂ ਜਿਹੜੀ ਹੈਗੀ ਹੈਗੀ ਵੋਚ ਲਓ ਸੋ ਮੈਂ ਬਹੁਤ ਜ਼ਿਆਦਾ ਥੈਂਕਫੁੱਲ ਹੈਗੀ ਹਾਂ ਤੁਹਾਡੀ